ਮੈਂ ਪੰਜਾਬ ਦੀ ਨਿਵਾਸੀ ਆ ਪੰਜਾਬ ਦੇ ਘਰ ਖੁੱਲ੍ਹੇ ਹੁੰਦੇ ਨੇ ਤਾਂ ਅਸੀਂ ਜ਼ਿਆਦਾਤਰ ਜੋ ਵੀ ਬਾਗਬਾਨੀ ਹੈ ਅਸੀਂ ਆਪਣੇ ਵਿਹੜੇ ਵਿੱਚ ਹੀ ਉਗਾਉਂਦੇ ਹਾਂ ਜਿਵੇਂ ਕਿ ਫੁੱਲ ਫਲ ਅਤੇ ਸਬਜ਼ੀਆਂ ਫੁੱਲਾਂ ਨੂੰ ਜ਼ਿਆਦਾਤਰ ਅਸੀਂ ਗਮਲਿਆਂ ਵਿੱਚ ਜਿਵੇਂ ਛੱਤ ਉੱਪਰ ਵੀ ਇੱਕ ਘਰ ਨੂੰ ਸਜਾਉਣ ਲਈ ਰੱਖ ਦਿੰਦੇ ਹਾਂ ਵਧੀਆ ਜਿਵੇਂ ਗੁਲਾਬ ਸੂਰਜਮੁਖੀ ਚਮੇਲੀ ਆਦਿ ਅਤੇ ਫਲਾਂ ਵਿੱਚ ਅਮਰੂਦ ਅਨਾਰ ਚੀਕੂ ਔ ਆਦਿ ਅਤੇ ਸਬਜ਼ੀਆਂ ਤਾਂ ਅਸੀਂ ਖੇਤ ਅਤੇ ਘਰ ਦੇ ਵਿਹੜੇ ਵਿੱਚ ਦੋਨਾਂ ਵਿੱਚ ਹੀ ਉਗਾਉਂਦੇ ਹਾਂ ਤਾਂ ਜੋ ਅਸੀਂ ਤਾਜ਼ੀਆਂ ਸਬਜ਼ੀਆਂ ਘਰ ਤੋਂ ਹੀ ਪ੍ਰਾਪਤ ਕਰ ਸਕੀਏ ਬਜ਼ਾਰ ਜਾਣ ਦੀ ਜ਼ਰੂਰਤ ਹੀ ਨਾ ਪਵੇ ਬਜ਼ਾਰ ਕਿ ਜਿਵੇਂ ਅੱਜ ਕੱਲ੍ਹ ਕੈਮੀਕਲ ਵਾਲੀਆਂ ਆ ਰਹੀਆਂ ਨੇ ਸਬਜ਼ੀਆਂ ਤੋਂ ਉਸ ਤੋਂ ਬਚਣ ਲਈ ਅਸੀਂ ਸਬਜ਼ੀਆਂ ਆਪਣੇ ਘਰੇ ਹੀ ਤਿਆਰ ਕਰਦੇ ਹਾਂ ਅਤੇ ਅਸੀਂ ਉਹੀ ਤਿਆਰ ਕਰਕੇ ਖਾਂਦੇ ਹਾਂ ਅਤੇ ਇਸ ਨਾਲ ਜਿਹੜੀ ਸਿਹਤ ਹੈ ਸਾਡੀ ਉਹ ਵੀ ਵਧੀਆ ਰਹਿੰਦੀ ਹੈ ਇਹ ਬਿਨਾਂ ਰੇਹ ਸਪਰੇਹ ਤੋਂ ਘਰੇ ਆਪ ਅਸੀਂ ਆਪਣੀਆਂ ਜਿਹੜੀਆਂ ਸਬਜ਼ੀਆਂ ਉਹ ਤਿਆਰ ਕਰਦੇ ਹਾਂ ਉਹੀ ਖਾਂਦੇ ਹਾਂ ਉਹੀ ਬੱਚਿਆਂ ਨੂੰ ਖਵਾਉਂਦੇ ਹਾਂ ਅਸੀਂ